ਦੇਖੋ ਜੀ ਮਰਦ ਪੁਰਸ਼ ਜੋ ਹੁੰਦੇ ਹਨ ਮੰਡੀਆਂ ਵਿੱਚ ਉਹ ਕਾਫੀ ਜ਼ਿਆਦਾ ਮਦਦਗਾਰ ਵੀ ਹੈ ਅਤੇ ਕਾਫੀ ਜ਼ਿਆਦਾ ਸ਼ੋਸ਼ਣ ਵੀ ਕਰਦੇ ਹਨ ਪਰ ਆਪਾਂ ਸਹੀ ਅੱਜ ਦੇ ਇੰਟਰਨੈਟ ਤੋਂ ਵੀ ਮਦਦ ਲੈ ਸਕਦੇ ਹਾਂ ਅਤੇ ਆਪਾਂ ਯੂਟੀਊਬ 'ਤੇ ਵੀਡੀਓ ਦੇਖ ਕੇ ਵੀ ਮਦਦ ਲੈ ਸਕਦੇ ਹਾਂ ਕਿ ਕਿੱਦਾਂ ਸਹੀ ਫਸਲਾਂ ਦਾ ਰੇਟ ਮਿਲ ਸਕਦਾ ਗਾ ਅਤੇ ਆਪਾਂ ਮੱਧ ਪੁਰਸ਼ ਜੋ ਹੁੰਦੇ ਹਨ ਉਹਨਾਂ ਦਾ ਸਹਾਇਤਾ ਨਾ ਲੈਂਦੇ ਹੋਏ ਆਪਾਂ ਇਹ ਕਰ ਸਕਦੇ ਹਾਂ ਅਤੇ ਮੱਧ ਪੁਰਸ਼ ਆਪ ਨੂੰ ਸਹੀ ਨਾ ਗਾਈਡ ਕਰਦੇ ਹੋਏ ਸ਼ੋਸ਼ਣ ਵੀ ਕਰ ਜਾਂਦੇ ਹਨ ਕਿਉਂਕਿ ਜੋ ਫਸਲ ਦਾ ਰੇਟ ਜੋ ਫਸਲ ਦੀ ਜਾਣਕਾਰੀ ਵੇਚਣ ਦੀ ਇਹ ਇਹਨਾਂ ਨੂੰ ਹੀ ਹੁੰਦੀ ਹੈ ਅਤੇ ਇਹਨਾਂ ਦੇ ਨਾਲ ਨਾਲ ਇਹ ਗਲਤ ਜਾਣਕਾਰੀ ਦੇ ਕੇ ਆਪਾਂ ਨੂੰ ਆਪਣੇ ਨਾਲ ਸ਼ੋਸ਼ਣ ਕਰ ਲੈਂਦੇ ਹਨ